ਹਾਂ ਜਦੋਂ ਮੈਂ ਕੱਪੜੇ ਸਿਲਾਈ ਕਰਦੀ ਹਾਂ ਤਾਂ ਮੈਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਛ ਕੱਪੜੇ ਐਦਾਂ ਦੇ ਹੁੰਦੇ ਹੈ ਜਿਨ੍ਹਾਂ ਨੂੰ ਸਿਲਾਈ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਇੱਕ ਵਾਰ ਮੇਰੇ ਪਾਸ ਐਦਾਂ ਦੀ ਸ਼ਰਟ ਆਈ ਸਿਲਾਈ ਕਰਨ ਨੂੰ ਕਿ ਉਸ 'ਤੇ ਨਾ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਸੀ ਸਟੋਨ ਦਾ ਜਦੋਂ ਮੈਂ ਸਿ ਸਿਲਾਈ ਮਾਰ ਰਹੀ ਸੀ ਜਿੱਥੇ ਜਿੱਥੇ ਸਿਲਾਈ ਮਾਰ ਰਹੀ ਤੀ ਉੱਥੇ ਸਟੋਨ ਆ ਰਿਹਾ ਤਾ ਔਰ ਵਾਰ ਵਾਰ ਮਸ਼ੀਨ ਦੀ ਸੂਈ ਟੁੱਟ ਰਹੀ ਤੀ ਪਰ ਫਿਰ ਵੀ ਮੈਂ ਬੜੀ ਮੁਸ਼ਕਲ ਨਾਲ ਉਹ ਸੂਟ ਤਿਆਰ ਕੀਤਾ ਔਰ ਉਹ ਸੂਟ ਬਹੁਤ ਜ਼ਿਆਦਾ ਵਧੀਆ ਬਣਿਆ ਔਰ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਇਆ